ਭ੍ਰਿਸ਼ਟਾਚਾਰ ਬੇਈਮਾਨੀ ਦਾ ਇੱਕ ਰੂਪ ਹੈ ਜਾਂ ਇੱਕ ਅਪਰਾਧਿਕ ਜ਼ੁਰਮ ਹੈ ਜੋ ਕਿਸੇ ਵਿਅਕਤੀ ਜਾਂ ਸੰਸਥਾ ਦੁਆਰਾ ਕੀਤਾ ਜਾਂਦਾ ਇਸ ਜਿਸਨੂੰ ਅਥਾਰਟੀ ਦੇ ਅਹੁਦੇ 'ਤੇ ਸੌਂਪਿਆ ਗਿਆ ਹੈ ਕਿਸੇ ਦੇ ਨਿੱਜੀ ਲਾਭ ਲਈ ਨਜਾਇਜ਼ ਲਾਭ ਪ੍ਰਾਪਤ ਕਰਨ ਜਾਂ ਸ਼ਕਤੀ ਦੀ ਦੁਰਵਰਤੋਂ ਕਰਨ ਲਈ ਭ੍ਰਿਸ਼ਟਾਚਾਰ ਵਿੱਚ ਬਹੁਤ ਸਾਰੀਆਂ ਗਤੀਵਿਧੀਆਂ ਸ਼ਾਮਿਲ ਹੋ ਸਕਦੀਆਂ ਹਨ ਜਿਸ ਵਿੱਚ ਰਿਸ਼ਵਤਖੋਰੀ ਪ੍ਰਭਾਵ ਪੈਡਲਿੰਗ ਅਤੇ ਗਬਨ ਸ਼ਾਮਿਲ ਹੋ ਸਕਦੇ ਹਨ ਅਤੇ ਇਸ ਵਿੱਚ ਉਹ ਅਭਿਆਸ ਵੀ ਸ਼ਾਮਿਲ ਹੋ ਸਕਦੇ ਹਨ ਜੋ ਕਈ ਦੇਸ਼ਾਂ ਵਿੱਚ ਕਾਨੂੰਨੀ ਹਨ ਸਿਆਸੀ ਭ੍ਰਿਸ਼ਟਾਚਾਰ ਉਦੋਂ ਹੁੰਦਾ ਹੈ ਜਦੋਂ ਕੋਈ ਦਫਤਰੀ ਅਧਿਕਾਰੀ ਜਾਂ ਹੋਰ ਸਰਕਾਰੀ ਕਰਮਚਾਰੀ ਨਿੱਜੀ ਲਾਭ ਲਈ ਅਧਿਕਾਰਿਤ ਸਮਰੱਥਾ ਨਾਲ ਕੰਮ ਕਰਦਾ ਹੈ ਇੱਕ ਵਾਰ ਅਸੀਂ ਬਾਈਕ 'ਤੇ ਜਾ ਰਹੇ ਸੀ ਤਾਂ ਪੁਲਿਸ ਵਾਲਿਆਂ ਨੇ ਸਾਡਾ ਬਿਨਾ ਵਜ੍ਹਾ ਤੋਂ ਚਲਾਨ ਕਰ ਦਿੱਤਾ ਸਾਡੇ ਕੋਲ ਸਾਰੇ ਫਾਰਮ ਵੀ ਪੂਰੇ ਸਨ ਇਹ ਸੀ ਕਿ ਉਹ ਸਾਡੇ ਤੋਂ ਰਿਸ਼ਵਤ ਭਾਲਦੇ ਸਨ ਪਰ ਸਾਡੇ ਕੋਲ ਸਾਰੇ ਡਾਕੂਮੈਂਟ ਵੀ ਪੂਰੇ ਸਨ